ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਹੀਂ ਮੈਂ ਨਹੀਂ ਪਛਾਣਿਆ ਜੀ ਕੌਣ ਜੀ ਅੱਛਾ ਅੱਛਾ ਅੱਛਾ ਠੀਕ ਆ ਠੀਕ ਆ ਹਾਂ ਤੁਸੀਂ ਮੈਨੂੰ ਹਾਂ ਸਤਿ ਸ਼੍ਰੀ ਅਕਾਲ ਬੁਲਾਈ ਸੀ ਹਾਂਜੀ ਮੈਂ ਪਛਾਣਿਆ ਨਹੀਂ ਸੀ ਪਹਿਲਾਂ ਮੈਂ ਦੇਖਿਆ ਨਹੀਂ ਸੀ ਮੈਂ ਤਾਂ ਵੈਸੇ ਹੀ ਬੁਲਾਤੀ ਸੀ ਮੈਂ ਕਿਹਾ ਚਲੋ ਬੰਦਾ ਬੁਲਾਉਂਦਾ ਆਪਾਂ ਬੁਲਾ ਲੀਏ ਮੈਂ ਤੁਹਾਨੂੰ ਪਛਾਣਿਆ ਨਹੀਂ ਸੀਗਾ ਅ ਅੱਛਾ ਅੱਛਾ ਅੱਛਾ ਠੀਕ ਆ ਚਲੋ ਵਧੀਆ ਵੈਲਕਮ ਜੀ ਵੈਲਕਮ ਵੈਲਕਮ ਕਰਦੇ ਤੁਹਾਡਾ ਅਸੀਂ

ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜਦੋਂ ਮਰਜ਼ੀ ਗੱਲ ਕਰੋ ਦਿਨ ਹੋਵੇ ਰਾਤ ਹੋਵੇ ਜਦੋਂ ਮਰਜ਼ੀ ਫੋਨ ਕਰੋ ਆਪਾਂ ਨੂੰ ਹਾਂਜੀ ਹਾਂ ਹਾਂਜੀ ਹਾਂਜੀ ਇਹ ਤਾਂ ਗਵਾਂਢ ਦੇ ਵਿੱਚ ਤੁਹਾਨੂੰ ਵਧੀਆ ਬਣਾ ਕੇ ਰੱਖਣਾ ਪੈਂਦਾ ਜੀ ਆਪਾਂ ਤਾਂ ਚੰਗਾ ਕ ਬੋਲਾਂਗੇ ਕਿਸੇ ਨੂੰ ਅਗਲਾ ਮੂਹਰੋਂ ਵੀ ਚੰਗਾ ਬੋਲੇਗਾ ਫਿਰ ਐਂਈਂ ਰਿਸ਼ਤੇ ਬਣਦੇ ਜੀ ਫੇਰ ਐਂਈਂ ਆਪਣਾ ਮੋਹ ਪਿਆਰ ਵੱਧ ਜਾਂਦਾ ਜੀ ਹਾਂਜੀ ਹਾਂ ਹਾਂਜੀ ਹਾਂਜੀ ਦੱਸੋ ਦੱਸੋ ਹਾਂਜੀ ਕੋਈ ਨਹੀਂ ਅੱਛਾ ਅੱਛਾ ਅੱਛਾ ਹਾਂ ਹਾਂ ਹਾਂਜੀ ਹਾਂਜੀ ਨਹੀਂ ਕੋਈ ਆਪਣੇ ਨਾ ਬਜ਼ ਆਪਣੇ ਬਾਜ਼ਾਰ ਦੇ ਵਿੱਚ ਘਰਾਂ ਦੇ ਨੇੜੇ ਥੋੜ੍ਹਾ ਜਿਹਾ ਅੱਗੇ ਜਾ ਕੇ ਸ਼ਰਮਾ ਡੈਅਰੀ ਹੈਗੀ ਬਹੁਤ ਵਧੀਆ ਦੁੱਧ ਆ ਅਤੇ ਦਹੀਂ ਵਗੈਰਾ ਹਾਂ ਪਨੀਰ ਵਗੈਰਾ ਪੂਰਾ ਫਰੈਸ਼ ਮਿਲਦਾ ਉੱਥੋਂ ਸਾਰੇ ਲੈ ਕੇ ਜਾਂਦੇ ਆ ਉੱਥੇ ਹਾਂ ਅਤੇ ਤੁਸੀਂ ਫੇਰ ਨਾ ਤੁਸੀਂ ਮੇਰੇ ਨਾਲ ਵਗ ਚੱਲਿਓ ਕੋਈ ਗੱਲ ਨਹੀਂ ਅਤੇ ਤੁਸੀਂ ਮੈਂ ਦੁਕਾਨ ਦਿਖਾ ਦੂੰਗਾ ਤੁਸੀਂ ਉੱਥੋਂ ਲੈ ਲਿਆ ਕਰੋ ਪੂਰਾ ਵਧੀਆ ਅਜ ਅਸੀਂ ਉੱਥੋਂ ਯੂਜ ਕਰਦੇ ਹੈਗੇ ਮਠਿਆਈਆਂ ਵਗੈਰਾ ਹੁਣ ਜਿਵੇਂ ਤਿਉਹਾਰ ਚੱਲਦੇ ਆ ਹੁਣ ਅਸੀਂ ਇਕੱਠਾ ਦੁੱਧ ਲੈ ਆਉਂਦੇ ਹਾਂ ਅਤੇ ਘਰ ਖੋਆ ਕੱਢਦੇ ਹਾਂ ਮਠਿਆਈਆਂ ਵਗੈਰਾ ਬਣਾਉਂਦੇ ਹਾਂ ਅਸੀਂ ਹਾਂ ਹਾਂ ਪੂਰਾ ਵਧੀਆ ਨਿਕਲਦਾ ਹਾਂ ਹਾਂ ਤੁਹਾਨੂੰ ਦੁੱਧ ਕਿੰਨੇ 'ਚ ਕਿੰਨਾ ਕੁ ਯੂਜ਼ ਕਰਦੇ ਹੋ ਤੁਸੀਂ ਡੇਲੀ ਦਾ ਅੱਛਾ ਅੱਛਾ ਅੱਛਾ ਠੀਕ ਜੀ ਹਾਂ ਬੱਚੇ ਪਰਿਵਾਰ ਵੱਡਾ ਹੋਊਗਾ ਤੁਹਾਡਾ ਹਾਂਜੀ ਹਾਂ ਹਾਂਜੀ ਹਾਂਜੀ ਇਹ ਤਾਂ ਫਿਰ ਆ ਸਹੀ ਗੱਲ ਆ ਹਾਂ ਨਹੀਂ ਉਹ ਉਹਨਾਂ ਦਾ ਪੂਰਾ ਵਧੀਆ ਉਹਨਾਂ ਦੀ ਗਰੰਟੀ ਆ ਉਹਨਾਂ ਨੇ ਇਨਾਮ ਰੱਖਿਆ ਹੈਗਾ ਜੇ ਸਾਡੇ ਦੁੱਧ 'ਚ ਕੋਈ ਮਿਲਾਵਟ ਘੋਸ਼ਿਤ ਕਰਦੇ ਜਾਂ ਕੋਈ ਪਨੀਰ ਦੇ ਵਿੱਚ ਕੋਈ ਮਿਲਾਵਟ ਦੱਸਦੇ ਕਹਿੰਦੇ ਅਸੀਂ ਵੀ ਦਸ ਹਜ਼ਾਰ ਰੁਪਏ ਦਾ ਇਨਾਮ ਦੇਵਾਂਗੇ ਅਸੀਂ ਐਨੀ ਗਰੰਟੀ ਨਾਲ ਉਹ ਆਪਦਾ ਕਾ ਕਾਰੋਬਾਰ ਚਲਾਉਂਦੇ ਨੇ ਉਹ ਹਾਂਜੀ ਹਾਂ ਹਾਂ ਹਾਂ ਅਸੀਂ ਅਸੀਂ ਸ਼ੁਰੂ ਤੋਂ ਉਹਨਾਂ ਦਾ ਯੂਜ਼ ਕਰਦੇ ਕਿਉਂਕਿ ਹੁਣ ਸ਼ਹਿਰਾਂ ਵਿੱਚ ਤੁਹਾਨੂੰ ਪਤਾ ਮੱਝਾਂ ਵਗੈਰਾ ਨਹੀਂ ਰੱਖੀਆਂ ਜਾ ਸਕਦੀਆਂ ਉਹ ਵੀ ਜੋ ਡਿਊਟੀਆਂ ਵਗੈਰਾ 'ਤੇ ਜਾਂਦੇ ਹੈਗੇ ਇਸ ਕਰਕੇ ਜੀ ਉਹ ਉੱਥੇ ਚੱਲੀ ਸਾਨੂੰ ਵਧੀਆ ਹੋ ਗਈ ਦੁੱਧ ਜੀ ਉੱਥੋਂ ਵਧੀਆ ਹੁਣ ਦੁੱਧ ਮਿਲਦਾ ਹੈਗਾ ਉਹਨਾਂ ਦੇ ਪਨੀਰ ਵਗੈਰਾ ਸਾਡੇ ਬੱਚੇ ਖੁਸ਼ ਹੋ ਖਾਂਦੇ ਆ ਹਾਂ ਘਿਓ ਵਗੈਰਾ ਪੂਰਾ ਵਧੀਆ ਬਣਾਉਂਦੇ ਆ ਪਰ ਹੁੰਦਾ ਥੋੜ੍ਹਾ ਰੇਟ ਤਾਂ ਥੋੜ੍ਹਾ ਹੈਗਾ ਹਾਈ ਘਿਓ ਦਾ ਪਰ ਘਿਓ ਇੱਕ ਨੰਬਰ ਮਿਲੇਗਾ ਤੁਹਾਨੂੰ ਪਤਾ ਜਿਹੜੀ ਚੀਜ਼ ਓਰਿਜਨਲ ਹੋਊਗੀ ਉਹਦਾ ਰੇਟ ਵੀ ਮਾੜਾ ਮੋਟਾ ਫਿਰ ਹੋਊਗਾ ਵੱਧ ਹੁੰਦਾ ਹੀ ਹੈਗਾ ਘਿਓ ਤਾਂ ਹੁਣ ਹਾਂ ਸੱਤ ਸੌ ਰੁਪਏ ਕਿਲੋ ਦਿੰਦੇ ਨੇ ਪੂਰਾ ਵਧੀਆ ਘਿਓ ਹੁੰਦਾ ਪੂਰਾ ਦਾਣੇਦਾਰ ਘਿਓ ਹੁੰਦਾ ਪੂਰਾ ਵਧੀਆ ਹਾਂਜੀ ਹਾਂਜੀ ਹਾਂ ਹਾਂ ਹਾਂ ਨਾ ਨਾ ਚੀਜ਼ ਪੂਰੀ ਵਧੀਆ ਮਿਲੂ ਤੁਹਾਨੂੰ ਤੁਸੀਂ ਪਹਿਲਾਂ ਮੇਰੇ ਕੋਲ ਆ ਜਿਓ ਕੋਈ ਗੱਲ ਨਹੀਂ ਫਿਰ ਤੁਹਾਨੂੰ ਮੈਂ ਦੁਕਾਨ ਦਿਖਾ ਲਿਆਉਂਗਾ ਅਤੇ ਉੱਥੋਂ ਤੁਸੀਂ ਲੈਣਾ ਸ਼ੁਰੂ ਕਰ ਦਿਓ ਹਾਂਜੀ ਹਾਂ ਹਾਂਜੀ ਹਾਂ ਜ਼ਰੂਰ ਜ਼ਰੂਰ ਹਾਂਜੀ ਹਾਂ ਹਾਂ ਨਾ ਕੋਈ ਗੱਲ ਨਹੀਂ ਹਾਂਜੀ ਉਹ ਕਹਿੰਦੇ ਆਪਣਾ ਹਾਂ ਨੰਬਰ ਸੇਵ ਕਰ ਲਉ ਕੋਈ ਗੱਲ ਨਹੀਂ ਤੁਹਾਨੂੰ ਬੁਲਾਵਾਂਗੇ ਜੀ ਘਰ ਖਾਣਾ ਖੁਣਾ ਤਿਆਰ ਕਰਾਂਗੇ ਤੁਹਾਨੂੰ ਬੁਲਾਵਾਂਗੇ ਅਸੀਂ ਹਾਂਜੀ ਹਾਂਜੀ ਹਾਂ ਬਿਲਕੁਲ ਤੁਹਾਡਾ ਵੈਲਕਮ ਕਰਾਂਗੇ ਵਧੀਆ ਤਰੀਕੇ ਨਾਲ ਹਾਂਜੀ ਹਾਂ ਠੀਕ ਹੈ ਬਾਈ ਜੀ ਹੈਂ ਠੀਕ ਓਕੇ ਜੀ ਓ ਸਤਿ ਸ਼੍ਰੀ ਅਕਾਲ ਓਕੇ ਜੀ